ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਸਾਰੇ ਸਥਾਨਕ ਰਿਹਾਇਸ਼ੀ ਵਿਕਲਪ ਹਨ ਜਿਵੇਂ ਕਿ ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਸਾਰੇ ਪੀ ਜੀ ਬਣੇ ਹੋਏ ਹਨ ਜੋ ਕਾਲਜ ਵਿੱਚ ਪੜ੍ਹਦੇ ਬੱਚਿਆਂ ਲਈ ਅਤੇ ਆਇਲੈਟਸ ਕਰਦੇ ਬੱਚਿਆਂ ਲਈ ਰਹਿਣ ਲਈ ਥਾਂ ਪ੍ਰੋਵਾਈਡ ਕਰਦੇ ਹਨ ਅਤੇ ਹੋਰ ਜ਼ਰੂਰੀ ਸਹੂਲਤਾਂ ਉਪਲਬਧ ਕਰਦੇ ਹਨ ਅੱਜ ਕੱਲ੍ਹ ਸਥਾਨਕ ਰਿਹਾਇਸ਼ੀ ਇੱਕ ਵਪਾਰ ਹੀ ਦਾ ਸਾਧਨ ਹੀ ਬਣ ਗਿਆ ਹੈ ਲੋਕ ਛੋਟੇ ਛੋਟੇ ਕਮਰੇ ਬਣਾ ਕੇ ਕਿਰਾਏ 'ਤੇ ਦੇ ਰਹੇ ਹਨ ਮੋਹਾਲੀ ਵਿੱਚ ਛੋਟੇ ਘਰਾਂ ਦਾ ਕਿਰਾਇਆ ਤਿੰਨ ਕੁ ਹਜ਼ਾਰ ਤੋਂ ਲੈ ਕੇ ਛੇ ਕੁ ਹਜ਼ਾਰ ਤੱਕ ਹੁੰਦਾ ਹੈ ਜਿਸ ਵਿੱਚ ਉਹਨਾਂ ਨੂੰ ਤਿੰਨੋ ਟਾਈਮ ਦਾ ਖਾਣਾ ਵੀ ਦਿੱਤਾ ਜਾਂਦਾ ਹੈ ਅਤੇ ਵਾਈ ਫਾਈ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾਂਦੀ ਹੈ